ਦੇਖੋ ਮੇਰੇ ਮਾਤਾ ਪਿਤਾ ਤਾਂ ਪੜ੍ਹੇ ਲਿਖੇ ਸੀ ਲੇਕਿਨ ਮੇਰੇ ਦਾਦਾ ਦਾਦੀ ਪੜ੍ਹੇ ਲਿਖੇ ਨਹੀਂ ਸੀ ਪਰ ਮੇਰੇ ਦਾਦਾ ਜੀ ਦੀ ਇਹ ਸੋਚ ਸੀ ਕਿ ਉਹਨਾਂ ਨੇ ਆਪਣੇ ਵਿੱਚੇ ਮੇਰੇ ਪਾਪਾ ਨੂੰ ਮੇਰੇ ਤਾਇਆ ਜੀ ਨੂੰ ਮੇਰੀਆਂ ਭੂਆ ਨੂੰ ਸਭ ਨੂੰ ਪੜ੍ਹਾਇਆ ਕਿ ਜੋ ਅੱਜ ਉਸ ਜ਼ਮਾਨੇ ਵਿੱਚ ਮੇਰੇ ਪਾਪਾ ਵੀ ਕਾਫੀ ਪੜ੍ਹੇ ਲਿਖੇ ਸੀ ਔਰ ਅੱਛਾ ਬਿਜ਼ਨਸ ਕਰਦੇ ਸੀ ਔਰ ਮੇਰੇ ਉਹਨਾਂ ਨੇ ਮੇਰੀਆਂ ਭੂਆ ਵੀ ਕਾਫੀ ਪੜ੍ਹੀਆਂ ਲਿਖੀਆਂ ਹੈ ਕੋਈ ਡੋਕਟਰ ਹੈ ਕੋਈ ਟੀਚਰ ਸੀ ਉਸ ਜ਼ਮਾਨੇ 'ਚ ਅਤੇ ਉਹਨਾਂ ਨੂੰ ਉਹਨਾਂ ਨੇ ਸਭ ਨੂੰ ਸਿੱਖਿਆ ਦੇ ਚੰਗੇ ਮੌਕੇ ਦਿੱਤੇ ਅਤੇ ਉਹੀ ਆਉਣ ਵਾਲਾ ਟਾਈਮ ਅਸੀਂ ਵੀ ਪੜ੍ਹੇ ਲਿਖੇ ਹਾਂ ਔਰ ਸਾਡੇ ਮਾਂ ਪਿਓ ਨੇ ਵੀ ਸਾਨੂੰ ਪੜ੍ਹਾਇਆ ਹੈ ਜਿੰਨਾਂ ਅਸੀਂ ਪੜ੍ਹ ਸਕੇ ਹਾਂ ਔਰ ਇਸ ਤਰ੍ਹਾਂ ਹੀ ਸਾਡੇ ਘਰ 'ਚੋਂ ਸਿੱਖਿਆ ਦਾ ਸ਼ੁਰੂ ਤੋਂ ਹੀ ਮਾਹੌਲ ਸੀ ਕਿ ਸਿੱਖਿਆ 'ਤੇ ਪੂਰਾ ਹੀ ਉਹਨਾਂ ਨੇ ਯੋਗਦਾਨ ਦਿੱਤਾ ਹੈ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਲੜਕੇ ਹੈ ਜਾਂ ਲੜਕੀਆਂ ਕਿ ਇਹਨਾਂ ਨੂੰ ਨਹੀਂ ਪੜ੍ਹਾਉਣਾ ਉਹ ਕਹਿੰਦੇ ਕਿ ਜਿੰਨਾਂ ਤੁਸੀਂ ਪੜ੍ਹ ਸਕਦੇ ਹੋ ਪੜ੍ਹੋ ਇੱਦਾਂ ਦੀ ਕੋਈ ਗੱਲ ਨਹੀਂ ਸੀ ਬਾਕੀ ਹੁਣ ਦਾ ਜ਼ਮਾਨਾ ਤਾਂ ਹੋਰ ਹੈ ਅੱਜ ਕੱਲ੍ਹ ਤਾਂ ਕੁੜੀਆਂ ਕੀ ਮੁੰਡੇ ਕੀ ਸਭ ਹੀ ਪੜ੍ਹ ਰਹੇ ਹਨ ਔਰ ਆਉਂਦਾ ਟਾਈਮ ਪੜ੍ਹਨਾ ਵੀ ਚਾਹੀਦਾ ਹੈ ਪਰ ਕਈ ਘਰਾਂ 'ਚ ਹਲੇ ਵੀ ਸਿੱਖਿਆ ਨੂੰ ਲੈ ਕੇ ਬੜੀ ਉਹ ਹੈ ਕਿ ਕਈ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਚਾਹੁੰਦੇ ਹੈ ਕਹਿੰਦੇ ਕਿਹੜੀਆਂ ਨੌਕਰੀਆਂ ਹੈ ਇਹ ਗਲਤ ਹੈ ਨੌਕਰੀਆਂ ਨਹੀਂ ਹੈ ਤਾਂ ਕੋਈ ਗੱਲ ਨਹੀਂ ਲੇਕਿਨ ਬੱਚਿਆਂ ਦੇ ਹੱਥ 'ਚ ਐਜੂਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਐਜੂਕੇਸ਼ਨ ਨਾਲ ਇੱਕ ਪੜ੍ਹੇ ਲਿਖੇ ਬੱਚੇ ਦੀ ਸੋਚ 'ਚ ਬੜਾ ਫਰਕ ਪੈਂਦਾ ਇੱਕ ਅਨਪੜ੍ਹ ਬੱਚੇ ਦੀ ਅਤੇ ਇੱਕ ਪੜ੍ਹੇ ਲਿਖੇ ਦੀ ਸੋਚ ਦਾ ਬਹੁਤ ਫਰਕ ਹੈ ਔਰ ਉਹ ਜਿਹੜਾ ਪੜ੍ਹਿਆ ਲਿਖਿਆ ਇਨਸਾਨ ਹੋਏਗਾ ਉਹ ਜ਼ਰੂਰ ਅੱਗੇ ਵਧੇਗਾ ਔਰ ਉਹਦੀ ਸੋਚ ਅੱਗੇ ਡਿਵੈਲਪ ਹੋਏਗੀ ਜਿਸ ਕਾਰਨ ਸਾਡਾ ਸਮਾਜ ਸੁਧਰੇਗਾ ਔਰ ਸੁਧਾਰ ਲਿਆਇਆ ਜਾਵੇਗਾ